ਹੈਲੋ ਹਾਂਜੀ ਹੈਲੋ ਹਾਂਜੀ ਹਾਂਜੀ ਮਿਠਾਈ ਦੀ ਦੁਕਾਨ ਤੋਂ ਬੋਲਦੀ ਆ ਹਾਂਜੀ ਮਿਲ ਜਾਏਗੀ ਹਾਂਜੀ ਉਹੀ ਮਿਲ ਜਾਏਗੀ ਉਹ ਵੀ ਬਣਾਉਂਦੇ ਆ ਆਪਾਂ

ਅੱਠ ਸੌ ਰੁਪਏ ਕਿਲੋ ਹਾਂਜੀ ਪੋਗਾ ਦੀ ਹੈਗੀ ਹੈ ਨੌ ਸੌ ਰੁਪਏ ਕਿਲੋ ਦੀ ਹੈਗੀ ਆ ਬਾਰ੍ਹਾਂ ਸੌ ਰੁਪਈਏ ਕਿਲੋ ਹਾਂਜੀ ਅੱਛਾ ਜੀ ਠੀਕ ਹੈ ਜੀ ਠੀਕ ਹੈ ਜੀ ਹੋਰ ਹੋਰ ਕੁਛ ਹੋਰ ਜਦੋਂ ਹੋਰ ਜਲੇਬੀਆਂ ਵੀ ਹੈਗੀਆਂ ਲੱਡੂ ਵੀ ਹੈਗੇ ਆ ਲੱਡੂ ਹੈਗੇ ਆ ਢਾਈ ਸੌ ਰੁਪਏ ਕਿਲੋ ਹਾਂਜੀ ਬਰਫੀ ਵੀ ਹੈਗੀ ਹੈ ਖੋਏ ਵਾਲੀ ਹਾਂਜੀ ਓਹ ਹੈਗੀ ਆ ਅੱਠ ਸੌ ਰੁਪਏ ਕਿਲੋ ਹਾਂਜੀ ਬਾਕੀ ਹਾਂਜੀ ਠੀਕ ਹੈ ਜੀ ਅੱਠ ਅੱਠ ਸੌ ਰੁਪਏ ਕਿਲੋ ਹੋ ਜਾਏਗੀ ਤੁਹਾਡੀ ਮਿਠਾਈ ਜਾਣੀ ਹਾਂਜੀ ਜਿੰਨੇ ਵਜੇ ਮਰਜ਼ੀ ਆ ਜਾਇਓ ਜੀ ਇੱਕ ਵਜੇ ਆ ਜਿਓ ਜੀ ਭਲਾ ਦੋੋ ਵਜੇ ਆ ਜਿਓ ਜੀ ਮਤਲਬ ਮਿਠਾਈ ਅੱਠ ਛੇ ਸੱਤ ਕਿਲੋ ਹੋ ਜਾਏਗੀ ਆਪਕੀ ਹਾਂਜੀ ਹਾਂਜੀ ਬੜੀਆ ਹੋਤੀ ਹੈ ਮਿਠਾਈ ਆਪ ਚੱਕ ਕੇ ਦੇਖ ਲੇ ਨਾ ਇਕ ਬਾਰ ਆ ਜਾਨਾ ਹਾਂ ਮਿਠਾਈ ਚਖ ਕੇ ਦੇਖ ਲੇਨਾ ਆਪਕੋ ਅੱਛੀ ਲਗੇਗੀ ਮਿਠਾਈ ਵਧੀਆ ਵਰਾਈਟੀ ਕੀ ਹੈ ਅੱਛੀ ਹੈ ਅੱਠੀ ਹੈ ਹਾਂਜੀ ਸਾਫ ਸੁਥਰੀ ਵੜੀਆ ਐਂਡ ਕੁਆਲਟੀ ਹੈ ਕੁਆਲਿਟੀ ਅੱਛੀ ਹੈ ਮਿਠਾਈ ਆਪਕੋ ਅੱਛੀ ਲਗੇਗੀ ਵਧੀਆ ਐਨ ਵਧੀਆ ਬਣਾਤੇ ਹੈ ਹਾਂਜੀ ਓ ਦੇਖ ਲੀਓ ਜਰਾ ਹਾਂ ਠੀਕ ਹੈ ਜੀ ਪੈਕ ਕਰਵਾ ਦੇਗੇ ਔਰ ਆਪ ਮਿਠਾਈ ਵੀ ਚੱਖ ਕੇ ਦੇਖ ਲੈਣਾ ਅੱਛੀ ਲੱਗੇਗੀ ਆਪਕੋ ਔਰ ਵੀ ਵਰਾਇਟੀ ਹੈ ਕਈ ਔਰ ਵੀ ਅੱਛੀ ਲਗੇ ਤੋ ਔਰ ਲੇ ਲੇਨਾ ਠੀਕ ਹੈ ਠੀਕ ਹੈ ਜੀ